ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਮਨੋਰੰਜਨ ਉਦਯੋਗ ਨੇ ਆਪ ਜੀ ਨੂੰ ਇੱਕ ਨਵੇਂ ਸਤਰ 'ਤੇ ਲੈ ਕੇ ਆਇਆ ਹਾਂ ਅਤੇ ਪ੍ਰੇਸ਼ਾਨੀਆਂ ਅਤੇ ਚੁਣੌਤੀਆਂ ਨਾਲ ਭਰੀ ਹੋਈ ਹੈ ਇਸ ਉਦਯੋਗ ਵਿੱਚ ਕੰਮ ਕਰਨ ਨਾਲ ਕਰਨ ਵਾਲੇ ਲੋਕਾਂ ਨੂੰ ਕੁਝ ਮੁੱਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਉਨ੍ਹਾਂ ਨੂੰ ਸੁਰੱਖਿਅਤ ਨਿਰਭਿਤ ਅਤੇ ਸੰਵੇਦਨਸ਼ੀਲ ਪ੍ਰਭਾਵਿਤ ਅਤੇ ਜ਼ਰੂਰਤ ਹੈ ਮਨੋਰੰਜਨ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਇਹ ਇੱਕ ਮਹੱਤਵਪੂਰਨ ਮੌਕਾ ਹੈ ਪ੍ਰੋਡਕਸ਼ਨ ਡਿਜ਼ਾਈਨਰ ਬਣਨ ਦਾ ਜੋ ਕਿ ਉਹ ਦੇਨ ਵਾਲੀ ਚੁਣੌਤੀਆਂ ਅਤੇ ਆਪਣੇ ਕੰਮ ਵਿੱਚ ਨਵਾਂ ਚਾਤਰ ਦੇ ਸਕਣ ਵਿੱਚ ਫੀਲਡ ਵਿੱਚ ਕਲਾ ਅਤੇ ਡਿਜ਼ਾਈਨਿੰਗ ਦੀ ਚਿੱਤਰ ਕਲਾ ਕਰਾਮਾਤਿਕ ਅਸ਼ੇਸ਼ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਇਸ ਰਾਹ 'ਤੇ ਜਾਣ ਵਾਲੇ ਲੋਕਾਂ ਨੂੰ ਚੁਣੌਤੀਆਂ ਅਤੇ ਹੋਰ ਨਾਲ ਸੰਪਰਕ ਕਰਨ 'ਤੇ ਅਵਸ਼ਕਤਾ ਜੋ ਉਹ ਸਾਹਸ ਪੂਰਤਾ ਦੀ ਸਹਾਇਤਾ ਨਾਲ ਨਵਨੀਤ ਲਾ ਸਕਣ ਮੌਜੂਦਾ ਸਥਿੱਤੀ ਵਿੱਚ ਪੰਜਾਬ ਦੇ ਮਨੋਰੰਜਨ ਉਦਯੋਗ ਆਪਸੀ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਕਾਗਜ਼ਕਾਰੀ ਪ੍ਰ ਪ੍ਰਭਾਵਿਤ ਬਜ਼ ਬੇਰੁਜ਼ਗਾਰੀ ਚੁਣੌਤੀਆਂ ਦੀ ਅਤੇ ਭਾਂਮ 'ਤੇ ਚੱਲਣਗੇ ਧੰਨਵਾਦ ਜੀ